ਰਾਜ ਦੇ ਇਤਿਹਾਸ ਅਤੇ ਸੱਭਿਆਚਾਰ ਬਾਰੇ ਹੋਰ ਜਾਣਨ ਵਿੱਚ ਦਿਸ ਦਿਲਚਸਪੀ ਰੱਖਣ ਵਾਲੇ ਸੈਲਾਨੀਆਂ ਲਈ ਕੁਝ ਵਿਕਲਪ ਇਹ ਹਨ ਜਿਵੇਂ ਅਜਾਇਬ ਘਰਾਂ ਅਤੇ ਸੱਭਿਆਚਾਰਕ ਕੇਂਦਰਾਂ ਬਾਰੇ ਜਾਣਨਾ ਵਿਰਾਸਤ ਏ ਖਾਲਸਾ ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ ਸੈਂਟਰ ਸਿੱਖ ਮਿਊਜ਼ੀਅਮ ਜਲ੍ਹਿਆਂਵਾਲਾ ਬਾਗ਼ ਜਿੱਥੇ ਤੱਕ ਜਲ੍ਹਿਆਂਵਾਲੇ ਬਾਗ਼ ਦੀ ਗੱਲ ਕਰੀਏ ਤਾਂ ਸਾਨੂੰ ਚਾਹੀਦਾ ਕਿ ਸੈਲਾਨੀ ਇੱਥੇ ਆਉਣ ਅਤੇ ਆ ਕੇ ਦੇਖਣ ਕਿ ਇੱਥੇ ਇੱਕ ਤਾਂ ਖੂਨੀ ਖੂਹ ਆ ਜਿਹਦੇ ਵਿੱਚ ਜਦੋਂ ਤੁਹਾਨੂੰ ਪਤਾ ਕਿ ਗੋਲੀਆਂ ਚੱਲੀਆਂ ਸੀਗੀਆਂ ਅਤੇ ਕਿਸ ਤਰ੍ਹਾਂ ਭਗਦੜ ਮੱਚੀ ਸੀ ਸੈਂਕੜੋਂ ਲੋਕ ਤੇਰਾਂ ਅਪ੍ਰੈਲ ਉੱਨੀ ਸੌ ਉੱਨੀ ਦੀ ਗੱਲ ਹੈ ਕਿ ਸੈਂਕੜੋਂ ਲੋਕ ਸੀ ਜਿਹੜੇ ਕਿ ਜਿਨ੍ਹਾਂ ਨੂੰ ਕਿ ਗੋਲੀਆਂ ਵੱਜੀਆਂ ਸੀ ਕੁਛ ਤਾਂ ਕੁਛ ਨੇ ਤਾਂ ਖੂੰਏ ਖੂੰਏ ਵਿੱਚ ਛ ਛਲਾਂਗ ਮਾਰ ਦਿੱਤੀ ਸੀ ਇਸ ਕਰਕੇ ਕਿ ਅਸੀਂ ਇਹਨਾਂ ਦੀਆਂ ਗੋਲੀਆਂ ਖਾਣ ਨਾਲ਼ੋਂ ਚੰਗਾ ਹੈ ਕਿ ਅਸੀਂ ਇਸ ਤਰ੍ਹਾਂ ਮਰ ਜੀਏ ਇਹਨਾਂ ਦੀ ਗੋਲੀ ਨਹੀਂ ਖਾਣੀ ਅਸੀਂ ਅਤੇ ਕੁਛ ਤੁਸੀਂ ਹੁਣ ਵੀ ਜਾ ਕੇ ਦੇਖੋ ਉੱਥੇ ਮਤਲਬ ਕਿ ਕਿਸ ਤਰ੍ਹਾਂ ਗੋਲੀਆਂ ਦੇ ਨਿਸ਼ਾਨ ਬਣੇ ਹੋਏ ਆ ਜਿਨ੍ਹਾਂ ਨੂੰ ਕਿ ਉਹਨਾਂ ਨੇ ਇੱਕ ਫਰੇਮ ਕਰਕੇ ਰੱਖਿਆ ਹੋਇਆ ਕਿ ਕੋਈ ਵੀ ਆਏ ਆ ਕੇ ਦੇਖੇ ਕਿ ਕਿਸ ਤਰ੍ਹਾਂ ਉਸ ਗੋਲੀਆਂ ਇੱਥੇ ਇੱਥੇ ਚੱਲੀਆਂ ਸੀਗੀਆਂ ਛੋਟੇ ਛੋਟੇ ਬੱਚੇ ਜਵਾਨ ਬੁੱਢੇ ਕਿਸ ਤਰ੍ਹਾਂ ਉਹਨਾਂ ਦੀ ਮੌਤ ਹੋਈ ਸੀਗੀ ਬਾਕੀ ਹੋਰ ਗੱਲ ਕਰੀਏ ਇੱਥੇ ਆਪਣੇ ਅਟਾਰੀ ਬਾਰਡਰ ਹੈ ਪਾਕਿਸਤਾਨ ਅਤੇ ਇੰਡੀਆ ਦੇ ਵਿਚਕਾਰ ਜਿਹੜਾ ਵਿੱਚ ਜਿਹੜਾ ਬਾਰਡਰ ਆਉਂਦਾ ਦੋ ਦੇਸ਼ਾਂ ਦੇ ਵਿਚਕਾਰ ਜਿਹੜੀਆਂ ਫੌਜਾਂ ਹੈਗੀਆਂ ਉੱਥੇ ਇੱਕ ਮਿਊਜ਼ੀਅਮ ਬਣਿਆ ਹੋਇਆ ਉੱਥੇ ਦੱਸਦੇ ਫੌਜਾਂ ਕਿਸ ਤਰ੍ਹਾਂ ਹੈਗੀਆਂ ਨੇ ਉਹਨਾਂ ਨੂੰ ਕਿਸ ਤਰ੍ਹਾਂ ਮਤਲਬ ਕਿ ਉੱਥੇ ਸਿਖਲਾਈ ਦਿੱਤੀ ਜਾਂਦੀ ਆ ਕਿਸ ਤਰ੍ਹਾਂ ਮਤਲਬ ਕਿ ਉਹਨਾਂ ਦੇ ਮਤਲਬ ਕਿ ਕੀ ਕੀ ਬਣਿਆ ਹੋਇਆ ਉਹਨਾਂ ਦੋਨਾਂ ਫੌਜਾਂ ਦੇ ਬਾਰਡਰ ਦੇ ਵਿੱਚ ਜੋ ਵੀ ਮਿਊਜ਼ਅਮ ਉਹਦੇ ਵਿੱਚ ਸਾਰਾ ਦੱਸਿਆ ਹੋਇਆ